ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੀਡੀਆ ਨੂੰ ਸਾਡੇ ਦੇਸ਼ ਦਾ ਚੌਥਾ ਸਤੰਭ ਵੀ ਕਿਹਾ ਜਾਂਦਾ ਹੈ ਭਾਰਤੀ ਮੀਡੀਆ ਸਾਨੂੰ ਦੇਸ਼ ਭਰ ਵਿੱਚ ਹੋ ਰਹੀਆਂ ਜੋ ਵੀ ਗਤੀਵਿਧੀਆਂ ਬਾਰੇ ਦੱਸਦਾ ਹੈ ਅਤੇ ਰਾਜਨੀਤਿਕ ਦੇ ਅਕੋਰਡਿੰਗ ਦੇਖੀਏ ਜੇ ਕਿ ਕੁਝ ਮੀਡੀਆ ਖਰੀਦਿਆ ਜਾ ਚੁੱਕਾ ਹੈ ਜੋ ਕਿ ਖਬਰਾਂ ਢੁੱਕਵੀਆਂ ਨਹੀਂ ਦਿੰਦੇ ਸਹੀ ਤੱਥ ਨਹੀਂ ਦਿਖਾਉਂਦੇ ਕਿਉਂਕਿ ਵਿਰੋਧੀ ਪੱਖ ਨੂੰ ਦਬਾਇਆ ਜਾਂਦਾ ਹੈ ਉਨ੍ਹਾਂ ਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ ਡਿਬੇਟ ਦੇ ਰਾਹੀਂ ਦੇਖੀਏ ਤਾਂ ਉਹਦੇ ਵਿੱਚ ਵੀ ਵਿਰੋਧੀ ਪੱਖ ਜਿਹੜਾ ਹੁੰਦਾ ਹੈ ਉਹਨੂੰ ਬੋਲਣ ਦਾ ਵੀ ਮੌਕਾ ਨਹੀਂ ਦਿੱਤਾ ਜਾਂਦਾ ਅਤੇ ਜਿਹਨੇ ਖ਼ਰੀਦਿਆ ਹੁੰਦਾ ਹੈ ਉਹ ਆਪਣਾ ਆਰਾਮ ਨਾਲ ਪੱਖ ਰੱਖ ਸਕਦਾ ਹੈ ਬਾਕੀ ਮਸ਼ਹੂਰ ਸਾਡੇ ਹੈਗੇ ਅਖ਼ਬਾਰਾਂ ਵਾਂ ਜਿੱਦਾਂ ਅਜੀਤ ਹੈਗੀ ਆ ਦੈਨਿਕ ਭਾਸਕਰ ਜਗਬਾਣੀ ਇਹ ਬਹੁਤ ਵਧੀਆ ਖ਼ਬਰਾਂ ਦਿੰਦੇ ਆ ਬਾਕੀ ਆਜ ਤੱਕ ਜੀ ਨਿਊਜ਼ ਐੱਨ ਡੀ ਟੀ ਵੀ ਨਿਊਜ਼ ਚੈਨਲ ਟਵੈਂਟੀ ਫੋਰ ਇਹ ਬਹੁਤ ਮਸ਼ਹੂਰ ਨੇ